ਮੈਂ ਆਪਣੇ ਪੇਂਡੂ ਭਾਈਚਾਰੇ ਵਿੱਚ ਸ਼ੁਰੂ ਕੀਤੇ ਕਾਰੋਬਾਰ ਬਾਰੇ ਚਰਚਾ ਕਰ ਰਿਹਾ ਮੈਂ ਦੋ ਹਜ਼ਾਰ ਬਾਈ ਦੇ ਵਿੱਚ ਇੱਕ ਮੁਰਗੀ ਫਾਰਮ ਸ਼ੁਰੂ ਕੀਤਾ ਸੀ ਜੋ ਕਿ ਬਹੁਤ ਹੀ ਸਫਲ ਰਿਹਾ ਮੈਂ ਇੱਕ ਸਾਲ ਦੋ ਹਜ਼ਾਰ ਬਾਈ ਤੋਂ ਲੈ ਕੇ ਦੋ ਹਜ਼ਾਰ ਤੇਈ ਵਿੱਚ ਬਹੁਤ ਹੀ ਚੰਗਾ ਮੁਨਾਫਾ ਕਮਾਇਆ ਜਿਸ ਜਿਸ ਕਿਤੇ ਨੇ ਮੈਨੂੰ ਸਫਲ ਬਣਾਇਆ ਹੈ ਉਹ ਹੈ ਪੋਲਟਰੀ ਫਾਰਮ ਲੇਅਰ ਫਾਰਮ ਜਿਸ ਵਿੱਚ ਮੁਰਗੀਆਂ ਦੇ ਆਂਡੇ ਵੇਚ ਕੇ ਅਸੀਂ ਬਹੁਤ ਹੀ ਵਧੀਆ ਕਾਰੋਬਾਰ ਚਲਾਇਆ ਹੈ ਇਸ ਲਈ ਮੈਨੂੰ ਪੋਲਟਰੀ ਫਾਰਮ ਨੇ ਇੱਕ ਸਫਲ ਫਾਰਮਰ ਬਣਾਇਆ ਹੈ